ਈ ਸੇਵਾ ਨਾਲ ਮੇਰਾ ਅਨੁਭਵ ਕ ਕਈ ਵਾਰ ਤਾਂ ਬਹੁਤ ਚੰਗਾ ਰਿਹਾ ਹੈ ਪਰ ਕਈ ਵਾਰ ਉਹ ਮੈਨੂੰ ਨਿਰਾਸ਼ਜਨਕ ਵੀ ਲੱਗਿਆ ਹੈ ਕਿਉਂਕਿ ਈ ਜਨਕ ਸੇਵਾਵਾਂ ਸਾਰੀਆਂ ਨਿਰਭਰ ਹੁੰਦੀਆਂ ਹਨ ਨੈੱਟ 'ਤੇ ਅਤੇ ਜੇ ਨੈੱਟ ਤੁਹਾਡਾ ਸਲੋ ਹੈ ਅਤੇ ਉਹ ਫਿਰ ਤੁਹਾਨੂੰ ਉਸ ਤਰੀਕੇ ਦਾ ਰਿਜਲਟ ਜਾਂ ਆਪਾਂ ਕਹਿ ਸਕਦੇ ਹਾਂ ਕਿ ਪਰਿਣਾਮ ਨਹੀਂ ਦਿੰਦੀਆਂ ਇਸ ਲਈ ਈ ਸੇਵਾਵਾਂ 'ਤੇ ਬੰਦੇ ਨੂੰ ਪੂਰਾ ਨਿਰਭਰ ਨਈਂ ਹੋਣਾ ਚਾਹੀਦਾ ਪਰ ਈ ਸੇਵਾਵਾਂ ਕਈ ਵਾਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਵੀ ਹੁੰਦੀਆਂ ਹਨ ਕੇ ਤੁਸੀਂ ਘਰੋਂ ਬਹਿ ਕੇ ਆਪਣਾ ਆਧਾਰ ਕਾਰਡ ਪੈਨ ਕਾਰਡ ਬੈਂਕ ਬੈਂਕਿੰਗ ਕਾਰਡ ਸਾਰਾ ਕੁਛ ਅਪਲਾਈ ਕਰ ਸਕਦੇ ਹੋਂ ਬ ਇੱਥੋਂ ਤੱਕ ਕਿ ਮੂਵੀ ਟਿਕਟਾਂ ਅਤੇ ਸਭ ਕੁਛ ਤੁਸੀਂ ਔਨਲਾਈਨ ਕਰ ਸਕਦੇ ਹੋਂ ਬਟ ਜੇ ਇਹ ਹੀ ਤੁਹਾਡੇ ਕੋਲ ਨੈੱਟ ਨਹੀਂ ਹੈ ਜਾਂ ਕਈ ਵਾਰ ਪਿੱਛੋਂ ਹੀ ਈ ਸੇਵਾਵਾਂ ਦਾ ਸਰਵਰ ਡਾਊਨ ਹੁੰਦਾ ਹੈ ਤਾਂ ਕਰਕੇ ਅਸੀਂ ਉਸ ਚੀਜ਼ ਦਾ ਲਾਭ ਨਹੀਂ ਉਠਾ ਪਾਂਉਦੇ ਅਤੇ ਕਈ ਵਾਰ ਉਹ ਪੈਸੇ ਦਾ ਨੁਕਸਾਨ ਵੀ ਕਰ ਦਿੰਦੀਆਂ ਹਨ ਇਸ ਲਈ ਇਹ ਸੇਵਾਵਾਂ ਦਾ ਮੇਰਾ ਅਨੁਭਵ ਬਹੁਤ ਚੰਗਾ ਵੀ ਹੋਇਆ ਹੈ ਅਤੇ ਕਈ ਵਾਰ ਅਤੇ ਕਈ ਵਾਰ ਬਹੁਤ ਨਿਰਾਸ਼ਜਨਕ ਵੀ